ਹੈਲੋ ਹਾਂਜੀ ਬਾਪੂ ਜੀ ਪੈਰੀ ਪੈਂਨਾ ਹੋਰ ਕਿਵੇਂ ਹੋ ਮੈਂ ਵੀ ਵਧੀਆ ਅੱਬੂ ਅਤੇ ਮੰਮੀ ਦੇ ਕੀ ਹਾਲ ਚਾਲ ਆ ਹਾਂਜੀ ਬਹੁਤ ਵਧੀਆ ਮੈਂ ਤਾਂ ਪੜ੍ਹਾਈ ਤਾਂ ਵਧੀਆ ਚੱਲਦੀ ਆ ਬਸ ਉਹੀ ਆ ਥੋੜ੍ਹਾ ਨਾ ਪ੍ਰੈਸ਼ਰ ਵਾਧੂ ਆ ਯੂਨੀਵਰਸਿਟੀ 'ਚ ਥੋੜ੍ਹਾ ਉਹਦੇ ਕਰਕੇ ਨਾ ਮਤਲਬ ਨਹੀਂ ਐਕਚਲੀ ਨਾ ਸੱਚੀਂ ਦੱਸਦਾ ਇੱਥੇ ਨਾ ਅਸੈਨਮੈਂਟ ਹੋ ਗਈ ਇਹ ਸਭ ਕੁਛ ਨਾ ਟਰਮ ਪੇਪਰਾਂ ਕਰਕੇ ਹੁਣ ਦੇਖੋ ਕਿ ਪੇਪਰ ਵੀ ਆਉਣ ਲੱਗੇ ਆ ਸਾਡੇ ਇਹਦੇ ਕਰਕੇ ਨਾ ਥੋੜ੍ਹਾ ਜਿਹਾ ਹੋ ਜਾਂਦਾ ਬਾਪੂ

ਵੈਸੇ ਹੈਗੇ ਆ ਰੂਮਮੇਟ ਮੇਰੇ ਬਹੁਤ ਵਧੀਆ ਆਏ ਨੇ ਮਿਲੇ ਨਾ ਜਿਹੜੇ ਰੂਮਮੇਟ ਬਹੁਤ ਅੰ ਅੰਡਰਸਟੈਂਡਿੰਗ ਹੈ ਮੇਰੇ ਹੈਗੇ ਆ ਇੱਕ ਮੇਰਾ ਹਰਿਆਣੇ ਤੋਂ ਆ ਇੱਕ ਯੂ ਪੀ ਤੋਂ ਆ ਇੱਕ ਕੇਰਲਾ ਵਾਲਾ ਵਾ ਸਭ ਵਧੀਆ ਵਾ ਇੱਥੇ ਸਭ ਵਧੀਆ ਤੁਸੀਂ ਦੱਸੋ ਘਰ ਦੇ ਕੀ ਹਾਲ ਨੇ ਅਤੇ ਬਸ ਵਧੀਆ ਪੈਸੇ ਦੀ ਬਾਪੂ ਨਹੀਂ ਹਾਲ ਫਿਲਹਾਲ ਤਾਂ ਵੈਸੇ ਨਹੀਂ ਹੈਗੀ ਬਸ ਹਜੇ ਫੇਅਰਵੈੱਲ ਆਊਗੀ ਤਾਂ ਉਦੋਂ ਦੇਖਦੇ ਹਾਂ ਹਜੇ ਤਾਂ ਲੋੜ ਨਹੀਂ ਹੈਗੀ ਹਾਂਜੀ ਹਾਂਜੀ ਬਾਕੀ ਤਾਂ ਮੈਂ ਤਾਂ ਉਹੀ ਕਹਿੰਦਾ ਮੈਂ ਕਿਹਾ ਬੇਬੇ ਦਾ ਧਿਆਨ ਰੱਖਿਓ ਕਿਉਂਕਿ ਉਹਨਾਂ ਦੀ ਨਾ ਸਾਹ ਫੁੱਲਦੇ ਰਹਿੰਦੇ ਆ ਪਤਾ ਹੀ ਆ ਤੁਹਾਨੂੰ ਹੈ ਨਾ

ਨਹੀਂ ਬਾਕੀ ਇੱਥੇ ਟੀਚਰ ਬਹੁਤ ਵਧੀਆ ਮਿਲੇ ਨੇ ਨਹੀਂ ਨਹੀਂ ਬਾਪੂ ਗੇੜੀ ਤੇੜੀ ਜਾਈਦਾ ਹੁੰਦਾ ਹੁਣ ਤੁਹਾਨੂੰ ਪਤਾ ਹੀ ਆ ਪੇ ਪੇਪਰ ਪੁਪਰ ਆਉਣ ਲੱਗੇ ਨੇ ਹਾਂਜੀ

ਨਹੀਂ ਨਹੀਂ ਇੱਥੇ ਵੈਸੇ ਦੇਖਿਆ ਜਾਵੇ ਤਾਂ ਪੜ੍ਹਨ ਲਈ ਸਹੂਲਤਾਂ ਬਹੁਤ ਵਧੀਆ ਨੇ ਇੱਥੇ ਚੌਵੀ ਘੰਟੇ ਬਿਜਲੀ ਰਹਿੰਦੀ ਹੈ ਹੁਣ ਪਿੰਡ 'ਚ ਸਾਡੇ ਔਖਾ ਹੁੰਦਾ ਸੀ ਨਾ ਜਿਵੇਂ ਬਿਜਲੀ ਨਹੀਂ ਹੁੰਦੀ ਸੀਗੀ ਇੱਥੇ ਹੋਸਟਲ 'ਚ ਚੌਵੀ ਘੰਟੇ ਰਹਿੰਦੀ ਆ ਹੁਣ ਇਹ ਚੀਜ਼ ਦਾ ਵਧੀਆ ਹੋ ਗਿਆ ਕਿ ਰਾਤੀਂ ਰਾਤੀਂ ਵੀ ਪੜ੍ਹ ਲੈਂਦਾ ਹੁਣ ਮੈਂ ਖਾਣ ਪੀਣ ਲਈ ਬਹੁਤ ਵਧੀਆ ਚੱਲਦਾ ਪਿਆ ਬਾਪੂ ਮੈੱਸ ਦਾ ਤਾਂ ਇੱਦਾਂ ਹੀ ਆ ਹੁਣ ਤੁਹਾਨੂੰ ਪਤਾ ਹੀ ਹੈ ਤਾਂ ਮਤਲਬ ਹੁੰਦਾ ਪਰ ਕੋਈ ਨਹੀਂ ਹੁਣ ਅਡਜੈਸਟ ਦੇਖੋ ਇੱਕ ਚੀਜ਼ ਵਧੀਆ ਮਿਲਦੀ ਅਤੇ ਦੂਜੇ ਲਈ ਤਾਂ ਥੋੜ੍ਹਾ ਕਰਨਾ ਹੀ ਪੈਂਦਾ ਕੋਈ ਚੱਕਰ ਨਹੀਂ ਹੈ

ਹਾਂਜੀ ਹਾਂਜੀ ਬਾਪੂ ਤੁਸੀਂ ਵੀ ਖਿਆਲ ਰੱਖੋ ਖੇਤਾਂ ਖੁੱਤਾਂ 'ਤੇ ਰਾਤ ਨੂੰ ਨਾ ਜਾਇਆ ਕਰੋ ਠੀਕ ਆ ਠੀਕ ਆ ਬਾਪੂ ਧਿਆਨ ਰੱਖੋ ਓਕੇ ਸਤਿ ਸ਼੍ਰੀ ਅਕਾਲ